ਗਿਆਰ੍ਹਾਂ ਦਸੰਬਰ ਉੱਨੀ ਸੌ ਪੰਝੱਤਰ ਛੇ ਜੂਨ ਦੋ ਹਜ਼ਾਰ ਦੋ ਸੱਤ ਫਰਵਰੀ ਦੋ ਹਜ਼ਾਰ ਅੱਠ ਅਠਾਰ੍ਹਾਂ ਮਾਰਚ ਦੋ ਹਜ਼ਾਰ ਪੰਦਰ੍ਹਾਂ ਬਾਈ ਜੁਲਾਈ ਦੋ ਹਜ਼ਾਰ ਤੇਈ